ਸਾਡੇ ਖੇਤਰ ਵਿੱਚ ਬਹੁਤ ਰਵਾਇਤੀ ਖੇਡਾਂ ਹੁੰਦੀਆਂ ਹਨ ਜਿੱਦਾਂ ਕਿ ਕਬੱਡੀ ਕ੍ਰਿਕਟ ਫੁੱਟਬਾਲ ਆਦਿ ਖੇਡਾਂ ਹੁੰਦੀਆਂ ਹਨ ਅਤੇ ਇਹਨਾਂ ਦਾ ਬਹੁਤ ਲੋਕ ਆਨੰਦ ਮਾਣਦੇ ਹਨ ਜਾਂ ਖੇਡਦੇ ਹਨ ਕਬੱਡੀ ਦੇ ਵਿੱਚ ਟੋਟਲ ਸੱਤ ਖਿਡਾਰੀ ਹੁੰਦੇ ਹਨ ਅਤੇ ਇੱਕ ਖਿਡਾਰੀ ਇਹਦੇ ਵਿੱਚ ਕਬੱਡੀ ਦੇ ਵਿੱਚ ਦੋ ਟੀਮਾਂ ਹੁੰਦੀਆਂ ਹਨ ਦੋ ਟੀਮਾਂ ਵਿੱਚ ਇੱਕ ਟੀਮ ਨੇ ਜਿੱਤਣਾ ਹੁੰਦਾ ਹੈ ਅਤੇ ਜਿਹੜੀ ਟੀਮ ਦੇ ਜ਼ਿਆਦਾ ਪੁਆਇੰਟ ਹੁੰਦੇ ਹਨ ਅਤੇ ਉਹ ਟੀਮ ਜਿੱਤ ਜਾਂਦੀ ਹੈ ਅਤੇ ਲੋਕ ਕਬੱਡੀ ਦਾ ਬਹੁਤ ਆਨੰਦ ਮਾਣਦੇ ਹਨ ਅਤੇ ਕ੍ਰਿਕਟ ਕ੍ਰਿਕਟ ਦੇ ਵਿੱਚ ਟੋਟਲ ਗਿਆਰ੍ਹਾਂ ਖਿਡਾਰੀ ਹੁੰਦੇ ਹਨ ਉਹਦੇ ਵਿੱਚ ਵੀ ਦੋ ਟੀਮਾਂ ਹੁੰਦੀਆਂ ਹਨ ਅਤੇ ਜਿਹੜਾ ਦੋਵਾਂ ਟੀਮਾਂ ਵਿੱਚ ਇੱਕ ਟੀਮ ਜਿੱਤਦੀ ਹੈ ਤਾਂ ਉਸ ਟੀਮ ਨੂੰ ਜੇਤੂ ਕਰਿਆ ਜਾਂਦਾ ਹੈ ਜਿਹੜੀ ਟੀਮ ਦੇ ਜ਼ਿਆਦਾ ਪੁਆਇੰਟ ਹੁੰਦੇ ਹਨ ਅਤੇ ਐਵੇਂ ਫੁੱਟਬਾਲ ਦੀ ਟੀਮ ਵਿੱਚ ਜਿਹੜੀ ਟੀਮ ਜ਼ਿਆਦਾ ਪੁਆਇੰਟ ਲੈਂਦੀ ਹੈ ਤਾਂ ਉਹ ਟੀਮ ਨੂੰ ਜੇਤੂ ਕਰਿਆ ਜਾਂਦਾ ਹੈ ਤਾਂ ਸਾਡੇ ਖ਼ੇਤਰ ਵਿੱਚ ਬਹੁਤ ਬਹੁਤ ਖੇਡਾਂ ਹਨ ਜਿਹਦੇ ਲਈ ਲੋਕ ਬਹੁਤ ਆਨੰਦ ਮਾਣਦੇ ਹਨ